ਗੱਲ ਕਰੀਏ ਤਾਂ ਜੇਕਰ ਮੋਹਾਲੀ ਜ਼ਿਲ੍ਹੇ ਵਿੱਚ ਅਸੀਂ ਸਿਸਮਾ ਡੈਮ ਦੀ ਹੀ ਗੱਲ ਕਰਦੇ ਹਾਂ ਇਸਦੇ ਵਿੱਚ ਬਹੁਤ ਹੀ ਜ਼ਿਆਦੇ ਮਾਤਰਾ ਦੇ ਵਿੱਚ ਪਾਣੀ ਦੇਖਿਆ ਜਾਂਦਾ ਹੈ ਇਸ ਦੇ ਵਿੱਚ ਲੋਕ ਦੂਰੋਂ ਦੂਰੋਂ ਸਵੀਮਿੰਗ ਕਰਨ ਆਉਂਦੇ ਹਨ ਅਤੇ ਬੋਟਿੰਗ ਵੀ ਕਰਨ ਆਉਂਦੇ ਹਾਂ ਇਸ ਤਰ੍ਹਾਂ ਇਸ ਦੇ ਨਾਲ ਹੀ ਇੱਕ ਵਧੀਆ ਪਾਰਕ ਬਣੀ ਹੋਈ ਹੈ ਜਿਸ ਦੇ ਵਿੱਚ ਹਰਿਆਲੀ ਪੇੜ ਪੌਦੇ ਲਗਾਏ ਗਏ ਹਨ ਇਸ ਦੇ ਵਿੱਚ ਲੋਕ ਦੂਰ ਦੂਰ ਤੋਂ ਘੁੰਮਣ ਆਉਂਦੇ ਹਨ ਅਤੇ ਇਸਦਾ ਆਨੰਦ ਮਾਣਦੇ ਹਨ ਜੇਕਰ ਗੱਲ ਕਰੀਏ ਤਾਂ ਇਸਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਇੱਕ ਸੁਖਨਾ ਝੀਲ ਬਣਾਈ ਗਈ ਹੈ ਜਿਸ ਦੇ ਵਿੱਚ ਲੋਕ ਸਵੀਮਿੰਗ ਅਤੇ ਬੋਟਿੰਗ ਕਰਦੇ ਹਨ ਉਸੀ ਤਰ੍ਹਾਂ ਉੱਥੇ ਵੀ ਬਹੁਤ ਸਾਰੀਆਂ ਸੇਵਾਵਾਂ ਉਪਲੱਬਧ ਹਨ ਅਤੇ ਲੋਕ ਉੱਥੇ ਵੀ ਦੂਰ ਦੂਰ ਤੋਂ ਆ ਕੇ ਆਨੰਦ ਮਾਣਦੇ ਹਨ ਅਤੇ ਇਨ੍ਹਾਂ ਨਾਲ ਗਰਮੀਆਂ ਤੋਂ ਵੀ ਬਹੁਤ ਹੀ ਛੁਟਕਾਰਾ ਮਿਲਦਾ ਹੈ ਪਰੰਤੂ ਸਾਡੇ ਕਿਸੇ ਵੀ ਤਰ੍ਹਾਂ ਦੇ ਹੜ੍ਹ ਸੋਕੇ ਦੀ ਸਮੱਖਿਆ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਇਨ੍ਹਾਂ ਸਮੱਸਿਆਵਾਂ ਵਿੱਚ ਸਾਨੂੰ ਕਿਸੇ ਵੀ ਜਿਵੇਂ ਕਿ ਹੜ੍ਹ ਜਾਂ ਸੋਕਾ ਸੋਕੇ ਤੋਂ ਵੀ ਸਾਨੂੰ ਕੋਈ ਸਮੱਸਿਆ ਨਹੀਂ ਅਤੇ ਹੜ੍ਹ ਤੋਂ ਵੀ ਸਾਨੂੰ ਹੁਣ ਤੱਕ ਕੋਈ ਵੀ ਸਮੱਸਿਆ ਨਹੀਂ ਆਈ ਅਤੇ ਇਸ ਦਾ ਅਨੁਭਵ ਅਸੀਂ ਸਾਂਝਾ ਇਸ ਤਰ੍ਹਾਂ ਕਰਦੇ ਹਾਂ ਕਿ ਸਾਨੂੰ ਇਨ੍ਹਾਂ ਦੇ ਵਿੱਚੋਂ ਕੋਈ ਸਮੱਸਿਆ ਨਹੀਂ ਆਈ